ਸਤਿ ਸ਼੍ਰੀ ਅਕਾਲ ਸਰ ਕੀ ਤੁਸੀਂ ਸਵਿਗੀ ਤੋਂ ਬੋਲ ਰਹੇ ਹੋ ਮੈਂ ਪ੍ਰੇਰਨਾ ਪਠਾਨਕੋਟ ਤੋਂ ਬੋਲ ਰਹੀ ਹਾਂ ਮੈਂ ਸੁਣਿਆ ਹੈ ਕਿ ਸਾਡੇ ਇਲਾਕੇ ਵਿੱਚ ਇੱਕ ਨਵਾਂ ਕੈਫੇ ਖੁੱਲ੍ਹਿਆ ਹੈ ਜਿਸ ਦਾ ਨਾਂ ਵਿਕਟੋਰੀਆ ਕੈਫੇ ਹੈ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਕਿ ਇਸ ਦੀ ਰੇਟਿੰਗ ਕਿੰਨੀ ਹੈ ਅਤੇ ਲੋਕ ਇਸ ਨੂੰ ਕਿੰਨਾ ਪਸੰਦ ਕਰਦੇ ਹੈ ਅਤੇ ਇੱਥੇ ਕੀ ਕੀ ਖਾਣ ਨੂੰ ਮਿਲਦਾ ਹੈ ਦਰਅਸਲ ਗੱਲ ਇਹ ਹੈ ਕਿ ਅੱਜ ਮੇਰੇ ਛੋਟੇ ਭਰਾ ਦਾ ਜਨਮ ਦਿਨ ਹੈ ਅਤੇ ਮੈਂ ਸੋਚਿਆ ਉਸ ਨੂੰ ਇੱਕ ਛੋਟੀ ਜਿਹੀ ਪਾਰਟੀ ਦਿੱਤੀ ਜਾਵੇ ਇਸ ਕਰਕੇ ਮੈਂ ਸੋਚਿਆ ਕਿ ਮੈਂ ਇਸ ਨਵੇਂ ਕੈਫੇ ਵਿੱਚੋਂ ਕੁਛ ਮੰਗਵਾਵਾਂ ਅਤੇ ਇਸ ਨੂੰ ਚੈੱਕ ਕੀਤਾ ਇਸ ਚੈ ਤਾ ਜਾਵੇ ਕਿ ਇਸ ਦਾ ਖਾਣ ਵਾਲਾ ਅ ਖਾਣਾ ਖਾਣਾ ਟੇਸਟ ਹੈ ਜਾਂ ਨਹੀਂ ਅਤੇ ਕਿਰਪਾ ਕਰਕੇ ਤੁਸੀਂ ਮੇਰਾ ਔਡਰ ਲਿਖੋ ਇੱਕ ਪਲੇਟ ਸਮੋਸਾ ਦੋ ਪਲੇਟ ਨੋਡਲਸ ਚਾਰ ਪਲੇਟ ਮੋਮੋਜ ਪੰਜ ਪਲੇਟਾਂ ਸਪਰਿੰਗ ਰੋਲ ਇਹ ਸਭ ਕੁਝ ਸਨੈਕਸ 'ਚ ਅਤੇ ਰੋਟੀ ਵਿੱਚ ਹੈ ਤਿੰਨ ਪਲੇਟ ਰਾਜਮਾ ਦੋ ਪਲੇਟ ਚਾਵਲ ਚਾਰ ਪਲੇਟਾਂ ਨਾਨ ਅਤੇ ਇੱਕ ਤਿੰਨ ਬੋਲ ਸੂਪ ਦੇ ਵੀ ਇਹ ਸਭ ਤਾਂ ਹੋ ਗਿਆ ਸਨੈਕ ਅਤੇ ਰੋਟੀ ਅਤੇ ਮੈਨੂੰ ਇੱਕ ਮੈਨੂੰ ਚੋਕਲੇਟ ਕੇਕ ਚਾਹੀਦਾ ਹੈ ਚਾਰ ਪਾਊਂਡ ਦਾ ਚੋਕਲੇਟ ਕੇਕ ਬਸ ਇੰਨਾ ਹੀ ਹੈ ਔਡਰ ਮੇਰਾ ਅਤੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਮੈਨੂੰ ਜਲਦ ਤੋਂ ਦ ਜਲਦ ਤੋਂ ਜਲਦ ਦੱਸਿਆ ਦੱਸੋ ਕਿ ਇਹ ਸਭ ਕੁਝ ਉਹਨਾਂ ਕੋਲ ਮਿਲੇਗਾ ਜਾਂ ਨਹੀਂ ਤਾਂ ਕਿ ਮੈਂ ਅੱਗੇ ਜੇ ਨਹੀਂ ਮਿਲੇਗਾ ਤਾਂ ਮੈਂ ਹੋਰ ਕਿਸੇ ਕੈਫੇ ਤੋਂ ਮੰਗਵਾ ਸਕਾਂ ਅਤੇ ਆਪਣੇ ਭਰਾ ਦਾ ਜਨਮਦਿਨ ਮਨਾ ਸਕਾਂ ਆਸ਼ਾ ਕਰਦਾ ਹਾਂ ਕਿ ਤੁਸੀਂ ਮੈਨੂੰ ਪਤਾ ਕਰ ਕੇ ਜਲਦ ਹੀ ਪਤਾ ਕਰ ਕੇ ਮੈਨੂੰ ਫੋਨ ਕਰੋਗੇ ਅਤੇ ਮੈਨੂੰ ਨਿਰਾਸ਼ ਨਾ ਹੋਣ ਦੇਵੋਗੇ